ਮਲਵਈ ਭੰਗੜਾ ਅਤੇ ਵਿਅਕਤੀਗਤ ਭੰਗੜਾ ਕਿਉਂਕਿ ਇਹਨਾਂ ਦੇ ਵਿੱਚ ਕਰਨ ਵਿੱਚ ਮਜ਼ਾ ਵੀ ਆਉਂਦਾ ਹੈ ਅਤੇ ਜੋ ਵਿਅਕਤੀਗਤ ਭੰਗੜਾ ਉਸ ਵਿੱਚ ਕਿਸੇ ਦੂਸਰੇ ਆਦਮੀ ਦੀ ਜ਼ਰੂਰਤ ਨਹੀਂ ਪੈਂਦੀ